ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਹਾਂਜੀ ਜੀ ਮੇਰੀ ਗੱਲ ਹੋਈ ਸੀ ਉਨ੍ਹਾਂ ਨਾਲ ਹਾਂਜੀ ਹਾਂਜੀ

ਨਹੀਂ ਜੀ ਮੈਂ ਤਾਂ ਡੇ ਸਕੋਲਰ ਹਾਂ

ਅੱਛਾ ਜੀ ਤੇ ਪਹਿਲਾਂ ਤੁਸੀਂ ਕਿਹੜੀ ਮਤਲਬ ਉਹਦੇ ਵਿੱਚ ਡਿਗਰੀ 'ਚ ਲਿਆ ਵਾ ਪਾਰਟ ਅੱਛਾ ਬੀ ਟੈੱਕ ਆਈ ਟੀ ਅਤੇ ਇੱਧਰ ਕਲਾਈਮੇਟ ਜਿਵੇਂ ਕਿ ਮੈਂ ਕਹਿ ਰਿਹਾ ਵਾ ਅਤੇ ਇੱਧਰ ਫਿਲਹਾਲ ਤਾਂ ਵਿੱਚ ਵਿੱਚ ਕਦੇ ਕਦੇ ਗਰਮੀ ਹੋ ਜਾਂਦੀ ਹੈ ਜਿਵੇਂ ਧੁੱਪ ਨਿਕਲਦੀ ਹੈ ਉੱਦਾਂ ਇੱਧਰ ਠੰਡ ਦਾ ਮੌਸਮ ਆ ਅਤੇ ਨਹੀਂ ਨਹੀਂ ਇੱਥੇ ਹੀਟਰ ਦੀ ਤਾਂ ਨਹੀਂ ਲੋੜ ਪੈਣੀ ਤੁਹਾਨੂੰ ਕਿਉਂਕਿ ਧੁੱਪ ਬਹੁਤ ਹੋ ਜਾਂਦੀ ਹੈ ਧੁੱਪ ਸੇਕ ਲਓ ਅਰਾਮ ਨਾਲ ਹਾਂਜੀ ਅਤੇ ਕੱਪੜੇ ਆਪਣੇ ਮੋਟੇ ਅਤੇ ਮਤਲਬ ਨੌਰਮਲ ਜਿਹੜੇ ਤੁਸੀਂ ਪਾਉਂਦੇ ਹੋ ਉਹ ਲੈ ਆਇਓ ਦੋਨੋਂ ਹੀ ਕਿਉਂਕਿ ਕਲਾਈਮੇਟ ਚੇਂਜ ਹੁੰਦਾ ਰਹਿੰਦਾ ਵਾ ਉਰੇ ਐਪਰਲ ਤੋਂ ਤੁਹਾਡਾ ਨਵਾਂ ਸੈਸ਼ਨ ਸਟਾਟ ਹੈ ਨਾ ਅਤੇ ਉਸ ਤੋਂ ਬਾਅਦ ਤਾਂ ਸਮਰ ਆ ਜਾਣੇ ਫਿਰ ਮਤਲਬ ਤੁਸੀਂ ਫੁਲ ਸਲੀਵਜ ਰੱਖਿਓ ਕਿਉਂਕਿ ਅਗਰ ਹਾਫ ਸਲੀਵਜ ਰਖੋਗੇ ਤਾਂ ਤੁਹਾਡੀਆਂ ਬਾਹਵਾਂ ਪੂਰੀਆਂ ਕਾਲੀਆਂ ਹੋ ਜਾਣੀਆਂ ਹਾਂਜੀ ਇੱਧਰ ਗਰਮੀ ਤਾਂ ਹੁੰਦੀ ਹੈ ਕਾਫ਼ੀ ਅਤੇ ਤੁਹਾਨੂੰ ਏ ਸੀ ਰੂਮਜ ਵਗੈਰਾ ਤਾਂ ਕੋਲੇਜ ਪ੍ਰੋਵਾਈਡ ਕਰ ਹੀ ਦਵੇਗਾ ਹਾਂਜੀ ਤੁਸੀਂ ਮੈਨੂੰ ਕੌਲ ਕਰ ਸਕਦੇ ਹੋ ਮੈਂ ਤੁਹਾਨੂੰ ਸਵੇਰੇ ਸਾਢੇ ਅੱਠ ਵਜੇ ਤੋਂ ਲੈ ਕੇ ਸਾਢੇ ਚਾਰ ਤੱਕ ਕੋਲੇਜ ਵਿੱਚ ਹੀ ਮਿਲੂੰਗਾ ਹਾਂਜੀ ਤੁਸੀਂ ਬਸ ਇੱਕ ਵਾਰ ਕੌਲ ਕਰ ਕੇ ਦੱਸ ਦਿਓ ਮੈਨੂੰ ਹਾਂਜੀ

ਕੋਈ ਨਾ ਵੈਲਕਮ ਜੀ ਓਕੇ ਬਾਏ